ਸਵੀਟਸ ਅਤੇ ਪੇਸਟਰੀਜ਼ ਦੇ ਨਾਮ ਇਸ ਤਰ੍ਹਾਂ ਹਨ ਅਰੀਸਾ ਪੇਠਾ ਐਪਲ ਹਲਵਾ ਬੂੰਦੀ ਗਾਜਰ ਪਾਕ ਗੇਵਰ ਗੁਲਾਬ ਜਾਮਣ ਰਸਗੁੱਲਾ ਇਮਰਤੀ ਜਲੇਬੀ ਕਾਜੂ ਕਤਲੀ ਖੀਰ ਖਿਰਮੋਹਨ ਕੁਲਫੀ ਲੱਡੂ ਲੱਸੀ ਮੋਤੀ ਚੂਰ ਲੱਡੂ ਮੱਖਣ ਬੜਾ ਮਾਲਪੁਰਾ ਨਟ ਖਟਾਈ ਪੇਠਾ ਫਿਰਨੀ ਰਵਰੀ ਸੋਨ ਪਾਪੜੀ ਚਮ ਚਮ ਜਲੇਬੀ ਚੇਨਾ ਚਿਲੀ ਚੀਨਾ ਖੀਰੀ ਕੋਕੋਨਟ ਬਰਫੀ ਖੀਰ ਸਾਗਰ ਲਬਾਂਗਾ ਲਾਟੀਕਾ